ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਜੀ ਐਨ ਈ ਬੁੱਕ ਸ਼ੋਪ ਤੋਂ ਬੋਲ ਰਹੇ ਹੋ ਅੱਛਾ ਅਤੇ ਮੈਮ ਰੀਸੈਂਟਲੀ ਤੁਹਾਡੀ ਸਟੋਰ ਤੋਂ ਬੁਕਸ ਬਾਏ ਕੀਤੀਆਂ ਸੀਗੀਆਂ ਬੀ ਸੀ ਏ ਕੋਰਸ ਰਿਲੇਟਡ ਫਸਟ ਸਮੈਸਟਰ ਦੀ ਬੁੱਕਸ ਸੀਗੀਆਂ ਅਤੇ ਮੈਂ ਉਹਨਾਂ ਨੂੰ ਮਤਲਬ ਜ਼ਿਆਦਾ ਨਹੀਂ ਯੂਜ ਕੀਤਾ ਕੰਡੀਸ਼ਨ ਪੂਰੀ ਵਧੀਆ ਪਈ ਹੈ ਤਾਂ ਮੈਂ ਚਾਹੁੰਦਾ ਕਿ ਉਹਨਾਂ ਦੀ ਰੀਸੇਲ ਕਰਕੇ ਮੈਂ ਜੋ ਹੈ ਸੈਕਿੰਡ ਸਮੈਸਟਰ ਦੀਆਂ ਬੁੱਕਸ ਲੈ ਲਵਾਂ ਮੈਂ ਰੀਸੈਂਟ ਮੈਂ ਮੈਨੂੰ ਰੀਸਂਟ ਬਸ ਇੱਕ ਮਹੀਨਾ ਹੀ ਹੋਇਆ ਮੰਥ ਹੋਇਆ ਹਾਂਜੀ

ਬਟ ਮੈਮ ਮੈਂ ਉਹਦੀ ਕੰਡੀਸ਼ਨ ਪੂਰੀ ਵਧੀਆ ਪਈ ਹੈ ਮੈਂ ਇੱਕ ਵੀ ਮਤਲਬ ਕਾਟਾ ਵਗੈਰਾ ਨਹੀਂ ਮਾਰਿਆ ਅੱਛਾ ਅਤੇ ਮੈਮ ਸੈਕਿੰਡ ਸਮੈਸਟਰ ਦੀਆਂ ਬੁੱਕਸ ਅਵੇਲੇਬਲ ਹੋਣਗੀਆਂ ਤੁਹਾਡੇ ਕੋਲ ਅੱਛਾ ਅਤੇ ਕੋਡਿੰਗ ਦੀ ਹੈ ਕਿਹੜੇ ਪਬਲਿਸ਼ਰ ਦੀ ਹੈ ਮੈਮ ਨਹੀਂ ਮੈ ਮੈਨੂੰ ਡਾਕਟਰ ਘੁਮਾਰ ਦੀ ਚਾਹੀਦੀ ਹੈ ਅਤੇ ਜੀ ਮੈਮ ਕਿੰਨੇ ਕੁ ਦਿਨ ਅੱਛਾ ਦੋ ਤਿੰਨ ਦਿਨ ਅੱਛਾ ਅਤੇ ਮੈਮ ਇਹਨਾਂ ਦੀ ਪ੍ਰਾਈਜ਼ ਵੈਲਿਊ ਕਿੰਨੀ ਕੁ ਰਹੇਗੀ ਓਕੇ ਮੈਮ ਓਕੇ ਮੈਮ ਠੀਕ ਹੈ ਮੈਮ ਤਾਂ ਮੈਂ ਫਿਰ ਉਹਨਾਂ ਨੂੰ ਸੈਲ ਕਰਨ ਵੀ ਫਿਰ ਪਰਸੋਂ ਹੀ ਆਵਾਂ ਅਤੇ ਮੈਮ ਇਵਨਿੰਗ ਕਿੰਨੇ ਵਜੇ ਤੱਕ ਓਪਨ ਰਹਿੰਦੀ ਆ ਅੱਛਾ ਅਤੇ ਮੈਮ ਉਹ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਕੋਰਸਿਸ ਦੀ ਬੁੱਕਸ ਅਵੇਲੇਬਲ ਨੇ

ਅਤੇ ਮੈਮ ਹੁਣੇ ਤਾਂ ਤੁਸੀਂ ਕੁਮਾਰ ਦੀ ਅਵੇਲੇਬਲ ਨਹੀਂ ਹੈਗੀ ਓਕੇ ਮੈਮ ਓਕੇ ਬਾਈ ਮੈਮ